ਸਤਿ ਸ਼੍ਰੀ ਅਕਾਲ ਸਰ ਮੈਂ ਕਾਰਤਿਕ ਪਠਾਨਕੋਟ ਸ਼ਹਿਰ ਦਾ ਨਿਵਾਸੀ ਸਰ ਪ੍ਰਕਾਰ ਭਾਰਤ ਵਿੱਚ ਕਾਫ਼ੀ ਕਾਫ਼ੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਸਭ ਤੋਂ ਜ਼ਿਆਦਾ ਬੋਲਣ ਵਾਲੀ ਭਾਸ਼ਾ ਭਾਰਤ ਵਿੱਚ ਹਿੰਦੀ ਹੈਗੀ ਹੈ ਜੋ ਕਿ ਕਾਫ਼ੀ ਉੱਚ ਪੱਧਰ 'ਤੇ ਬੋਲੀ ਜਾਂਦੀ ਹੈ ਔਰ ਕਾਫ਼ੀ ਕਾਫ਼ੀ ਮਾਨਤਾ ਵੀ ਦਿੱਤੀ ਜਾਂਦੀ ਹੈ ਹਿੰਦੀ ਨੂੰ ਇਸ ਲਈ ਸਾਨੂੰ ਇਸ ਲਈ ਸਾਡੇ ਭਾਰਤ ਵਿੱਚ ਹੋਰ ਵੀ ਕਈ ਭਾਸ਼ਾਵਾਂ ਹਨ ਪਰ ਮੈਂ ਮੈਂ ਕਿ ਪੰਜਾਬ ਦਾ ਰਹਿਣ ਵਾਲਾ ਹਾਂ ਔਰ ਪੰਜਾਬੀ ਵੀ ਸਾਡੇ ਭਾਰਤ ਵਿੱਚ ਬੋਲੀ ਜਾਂਦੀ ਹੈ ਔਰ ਸਾਡੇ ਭਾਰਤ ਵਿੱਚ ਹੋਰ ਵੀ ਕਈ ਭਾਸ਼ਾਵਾਂ ਹਨ ਜਿਵੇਂ ਗੁਜਰਾਤੀ ਮਰਾਠੀ ਹੋਰ ਹੋਰ ਵੀ ਫਰਾਂਸ ਔਰ ਔਰ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜੋ ਕਿ ਸਾਨੂੰ ਕਈ ਸਿੱਖਿਆ ਦਿੰਦੀਆਂ ਹਨ ਕਿ ਸਾਨੂੰ ਇਹਨਾਂ ਦੀ ਇਹਨਾ ਭਾਸ਼ਾਵਾਂ ਦੀ ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਔਰ ਸਾਡੇ ਭਾਰਤ ਵਿੱਚ ਇੰਗਲਿਸ਼ ਵੀ ਬੋਲੀ ਜਾਂਦੀ ਹੈ ਇੰਗਲਿਸ਼ ਦੀ ਵੀ ਕਾਫ਼ੀ ਮਾਨਤਾ ਹੈਗੀ ਹੈ ਔਰ ਸਾਨੂੰ ਸਾਰੀ ਭਾਸ਼ਾਵਾਂ ਆਉਣੀਆਂ ਜ਼ਰੂਰੀ ਹਨ ਕਿਉਂਕਿ ਸਾਨੂੰ ਕੋਈ ਕੁਝ ਪਤਾ ਨਹੀਂ ਕਿਹੜੀ ਭਾਸ਼ਾ ਕਿੱਥੇ ਸਾਡੇ ਕੰਮ ਆ ਸਕਦੀ ਹੈ ਔਰ ਅਸੀਂ ਕਿਸ ਟਾਈਮ ਕਿਸ ਭਾਸ਼ਾ ਦਾ ਉਪਯੋਗ ਕਰਨਾ ਹੈ ਔਰ ਸਾਨੂੰ ਸਮੇਂ ਸਮੇਂ ਨਾਲ ਸਾਰੀ ਭਾਸ਼ਾਵਾਂ ਦਾ ਜ਼ਿਕਰ ਕਰਨਾ ਔਰ ਸੁਣਨਾ ਔਰ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ